ਪੇਂਟ ਕਰਨਾ ਵੀ ਇੱਕ ਕਲਾ ਹੈ ਅੱਜ ਕੱਲ ਸ ਸੂਟਾਂ ਤੇ ਵੀ ਪੇਂਟ ਕਰਨ ਦਾ ਰਿਵਾਜ਼ ਦੁਆਰਾ ਆ ਗਿਆ ਹੈ ਪੇਂਟ ਕਰਨ ਲਈ ਵੀ ਸਮਾਨ ਪੂਰਾ ਹੋਣਾ ਚਾਹੀਦਾ ਹੈ ਜਿਵੇਂ ਕਿ ਵਾਟਰ ਕਲਰ ਕਲਰ ਪੇਪਰ ਜਾਂ ਕੱਪੜਾ ਕੈਨਵਸ ਵੀ ਚਾਹੀਦਾ ਹੈ ਪੇਂਟ ਕਰਨ ਲਈ ਸਮਾਨ ਦੇ ਨਾਲ ਨਾਲ ਉਸ ਦੇ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਜਿ ਜਿਵੇਂ ਕਿਹੜਾ ਕਲਰ ਕਿਹੜੇ ਕਲਰ ਨਾਲ ਮੈਚ ਹੁੰਦਾ ਹੈ ਜਾਂ ਫੇਰ ਕਿਹੜੀ ਪੇਂਟਿੰਗ ਕਿਵੇਂ ਕਰਨੀ ਹੈ ਤਰ੍ਹਾਂ ਇਸ ਤਰ੍ਹਾਂ ਬਹੁਤ ਚੀਜ਼ਾਂ ਹਨ ਜੋ ਪੇਂਟ ਕਰਨ ਲਈ ਜਰੂਰੀ ਹਨ